ਭਾਰਤੀ ਕਲਾ ਸ਼ੈਲੀਆਂ ਅੱਜ ਕੱਲ੍ਹ ਅਲੋਪ ਹੋ ਰਹੀਆਂ ਨੇ ਇਹ ਪਹਿਲਾਂ ਕਿਵੇਂ ਹੁੰਦਾ ਸੀ ਪਹਿਲਾਂ ਪੁਰਾਣੇ ਸਮਿਆਂ ਵਿੱਚ ਲੋਕੀਂ ਲਾਲਟੇਨਾਂ ਵਰਤਦੇ ਸੀ ਹੁਣ ਲਾਈਟਾਂ ਆ ਗਈਆਂ ਹੈ ਨਾ ਅਤੇ ਪਹਿਲਾਂ ਚੁੱਲਿਆਂ ਚੁੱਲੇ ਵਰਤਦੇ ਸੀਗੇ ਮੰਜੇ ਹੁੰਦੇ ਸੀਗੇ ਪੀੜੀਆਂ ਹੁੰਦੀਆਂ ਸੀਗੀਆਂ ਮਧਾਣੀਆਂ ਹੁੰਦੀਆਂ ਚਰਖੇ ਹੁੰਦੇ ਸੀਗੇ ਹੁਣ ਸਾਰਾ ਕੁਛ ਇਲੈਕਟਰੋਨਿਕ ਆ ਗਿਆ ਕਿਉਂਕਿ ਲੋਕਾਂ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਹੁਣ ਉਹ ਉਹਨਾਂ ਜੋ ਸੋਰਸਿਸ ਹੈ ਉਹਨਾਂ ਨੂੰ ਵਰਤ ਸਕਣ ਇਸ ਕਰਕੇ ਉਹਨਾਂ ਨੇ ਜੋ ਘੱਟ ਟਾਈਮ ਕੰਜਿਊਮ ਕਰਦੇ ਉਹ ਸੋਰਸਿਸ ਲੈ ਲਏ ਅਤੇ ਆਪਣੇ ਸਮੇਂ ਦੀ ਆਪਣੇ ਸਮੇਂ ਨੂੰ ਪੂਰਾ ਕਰ ਪੂਰਾ ਕਰਨ ਲਈ ਅਤੇ ਜੇਹ ਜਿਹੜੇ ਹੋਰ ਵੀ ਕਿੰਨ ਵਿਆਹਾਂ ਵਿੱਚ ਕਿੰਨੇ ਡਿਫਰੈਂਸ ਆ ਗਏ ਪਹਿਲਾਂ ਵਿਆਹ ਮਨਾਏ ਕਿਵੇਂ ਕਰੇ ਜਾਂਦੇ ਸੀਗੇ ਕਿੰਨੀ ਸ਼ਾਨ ਸ਼ੌਕਤ ਨਾਲ ਕਰੇ ਜਾਂਦੇ ਸੀ ਕਿੰਨੀਆਂ ਟਾਈਮ ਤੱਕ ਜੰਝਾਂ ਮਤਲਬ ਬਰਾਤਾਂ ਬਰਾਤਾਂ ਕਿੰਨ ਤਿੰਨ ਤਿੰਨ ਦਿਨ ਰਹਿੰਦੀਆਂ ਸੀ ਹੁਣ ਤਾਂ ਕੋਈ ਇੱਕ ਦਿਨ ਵਿੱਚ ਅੱਧੇ ਦਿਨ ਵਿੱਚ ਵਿਆਹ ਕੇ ਲੈ ਜਾਂਦੇ ਅਤੇ ਹੋਰ ਵੀ ਕਿੰਨਾ ਕੁ ਕਿੰਨਾ ਡਿਫਰੈਂਸ ਆ ਕਲਚਰ ਡਿਫਰੈਂਸ ਕਿੰਨਾ ਆ ਗਿਆ ਰਹਿਣ ਸਹਿਣ ਦਾ ਡਿਫਰੈਂਸ ਕਿੰਨਾ ਆ ਗਿਆ ਬੋਲੀ ਪਹਿਰਾਵਾ ਹੈ ਨਾ ਸਾਰਾ ਕੁਛ ਏ ਕਿੰਨਾ ਡਿਫਰੈਂਸ ਆ ਗਿਆ ਅਪ ਅ ਅਸੀਂ ਲੋਕ ਹਾਂ ਪੁਰਾਣੇ ਦੇਸੀ ਘਿਓ ਖਾਣ ਤੋਂ ਕਿੰਨਾ ਕਤਰਾਉਂਦੇ ਹਾਂ ਅ ਨ ਉਹਦੀ ਜਗ੍ਹਾ ਪਹਿਲਾਂ ਲੋਕੀਂ ਸਾਗ ਖਾਂਦੇ ਸੀ ਮੱਕੀ ਰੋਟੀ ਲੱਸੀਆਂ ਪੀਂਦੇ ਸੀ ਦੁੱਧ ਘਿਓ ਸ਼ੱਕਰ ਕਿੰਨਾ ਖਾਂਦੇ ਸੀ ਅੱਜ ਕੱਲ੍ਹ ਦੇ ਬੱਚੇ ਬਿਲਕੁਲ ਨਹੀਂ ਖਾਣਾ ਪਸੰਦ ਕਰਦੇ ਸਿਰਫ ਫਾਸਟ ਫੂਡ ਨੂੰ ਭੱਜੇ ਰਹਿੰਦੇ ਆ ਭ ਜੋ ਕਿ ਸਾਡੀ ਸਿਹਤ ਲਈ ਨਹੀਂ ਠੀਕ ਇਹਦੇ ਨਾਲ ਸਾ ਇੱਕ ਤਾਂ ਸਾਡਾ ਸਾਡੀ ਸਿਹਤ ਖਰਾਬ ਹੁੰਦੀ ਉਪਰੋਂ ਸਾਡਾ ਇੰਨਾ ਇੰਨਾ ਮਹਿੰਗਾ ਫਾਸਟ ਫੂਡ ਹੁੰਦਾ ਅਸੀਂ ਫਿਰ ਵੀ ਫਾਸਟ ਫੂਡ ਨੂੰ ਹੀ ਲੈਂਦੇ ਹਾਂ ਬਜਾਏ ਸਿੰਪਲ ਖਾਣਾ ਖਾਣ ਦੀ ਜੋ ਕਿ ਸਾਡੇ ਲਈ ਨਹੀਂ ਸ ਸਹੀ ਹੈ ਹੋਰ ਵੀ ਕਿੰਨਾ ਕੁਛ ਪਹਿਲਾਂ ਵਿਆਹਾਂ ਵਿੱਚ ਜਾਗੋ ਮਨ ਜਾਗੋ ਕਿੰਨੀ ਵਧੀਆ ਤਰੀਕੇ ਨਾਲ ਕੱਢਦੇ ਸੀ ਲੋਕੀਂ ਸਾਰੇ ਮਿਲ ਜੁਲ ਕੇ ਤਿਉਹਾਰਾਂ ਨੂੰ ਮਨਾਉਂਦੇ ਸੀ ਹੁਣ ਹੁਣ ਆਪਣੇ ਆਪਣੇ ਘਰਾਂ ਵਿੱਚ ਹੀ ਮਨਾ ਕੇ ਬਸ ਥੋੜ ਥੋ ਥੋੜੇ ਥੋੜੇ ਟਾਈਮ ਵਿੱਚ ਮਨਾ ਕੇ ਬੈਠ ਜਾਂਦੇ ਹਾਂ ਜੋ ਕਿ ਜੋ ਕਿ ਨਹੀਂ ਠੀਕ ਹੈ ਇਹਨੂੰ ਸੰਭਾਲਣ ਦੀ ਲੋੜ ਹੈ ਕਿਉਂਕਿ ਆਉਣ ਵਾਲੀ ਪੀੜੀ ਇਸ ਇਹਨਾਂ ਕੰਮਾਂ ਨੂੰ ਬਿਲਕੁਲ ਵੀ ਨਹੀਂ ਮੰਨੇਗੀ ਉਹ ਆਪਣੇ ਆਪਣੇ ਤੱਕ ਹੀ ਆਪਣੇ ਆਪ ਤੱਕ ਹੀ ਸੀਮਿਤ ਰਹਿ ਜਾਏਗੀ ਜੋ ਕਿ ਸਾਡੇ ਸ ਲੋਕਾਂ ਲਈ ਠੀਕ ਨਹੀਂ ਹੈ